ਸਾਡੀ ਰੋਜ਼ੀ ਰੋਟੀ ਦੇ ਵਿੱਚ ਬਿਜਲੀ ਬਹੁਤ ਨਿਰਭਰ ਕਰਦੀ ਹੈ ਕਿਉਂਕਿ ਕਈ ਵਾਰੀ ਇਸ ਤਰ੍ਹਾਂ ਦੇਖਿਆ ਗਿਆ ਹੈ ਕਿ ਕੁਛ ਲੋਕਾਂ ਦੇ ਕੰਮ ਜਿਹੜੇ ਕਿ ਬਿਜਲੀ ਨਾਲ ਹੀ ਚੱਲਦੇ ਹਨ ਕਈਆਂ ਦੀ ਬਿਲ ਭੁਗਤਾਨਾਂ ਦੀ ਕੰਪਨੀਆਂ ਹੈ ਉਹ ਬਿੱਲ ਭੁਗਤਾਨ ਕਰਕੇ ਉਨ ਉਹਨਾਂ ਦੇ ਵਿੱਚ ਪੈਸਾ ਕਮਾਉਂਦੇ ਹਨ ਅਤੇ ਬਿਜਲੀ ਦੇ ਕੱਟ ਲੱਗਣਗੇ ਤਾਂ ਉਹ ਪੈਸਾ ਕਿੱਥੋਂ ਕਮਾਉਣਗੇ ਕਿਉਂਕਿ ਸਾਰੇ ਦੇ ਸਾਰੇ ਦਿਨ ਇਨਵਰਟਰ ਵੀ ਉਹ ਕਾਰਵਾਈ ਨਹੀਂ ਕਰ ਸਕਦਾ ਇਨਵਰਟਰ ਪੂਰੀ ਤਰ੍ਹਾਂ ਆਪਾਂ ਇਨਵਰਟਰ 'ਤੇ ਨਿਰਭਰ ਨਹੀਂ ਕਰ ਸਕਦੇ ਇਸ ਕਰਕੇ ਬਿਜਲੀ ਦੇ ਨਾਲ ਹੀ ਸਾਡਾ ਦੂਸਰੇ ਬਿਲ ਭੁਗਤਾਨ ਜਾਂ ਦੂਸਰੇ ਜਿੰਨੇ ਵੀ ਇੰਟਰਨੈਟ ਦੇ ਕੰਮ ਆ ਸਾਰੇ ਬਿਲ ਇਹਦੇ ਬਿਜਲੀ ਦੇ ਨਾਲ ਹੀ ਚੱਲਣਗੇ ਅਤੇ ਇਸ ਕਰਕੇ ਕੱਟ ਘੱਟ ਲੱਗਣੇ ਚਾਹੀਦੇ ਤਾਂ ਕਿ ਜੋ ਅਸੀਂ ਆਪਣੀ ਡੇਲੀ ਲਾਈਫ ਦੇ ਵਿੱਚ ਆਪਣਾ ਕੰਮ ਕਰ ਸਕੀਏ